ਕਿ ਮੈਂ ਰੋਪੜ ਬਜ਼ਾਰ ਤੋਂ ਆਪਣੇ ਲਈ ਇੱਕ ਸ਼ਲਟ ਖਰੀਦੀ ਹੈ ਸ਼ਲਟ ਬਹੁਤ ਵਧੀਆ ਅਤੇ ਪੱਕੇ ਰੰਗਦਾਰ ਦੀ ਹੈ ਅਤੇ ਕਿ ਮੈਂ ਉਸ ਨੂੰ ਬਹੁਤ ਸ਼ੌਕ ਦੇ ਨਾਲ ਵਰਤਦਾ ਹਾਂ ਅਤੇ ਬਹੁਤ ਵਧੀਆ ਤਿੰਨ ਚਾਰ ਸਾਲ ਹੋ ਗਏ ਜਿਵੇਂ ਨਵੀਂ ਹੈ ਉਵੇਂ ਹੀ ਪੁਰਾਣੀ ਦਿੱਸਦੀ ਹੈ